ਹਾਂਜੀ ਡਾਕਟਰ ਹਰਪ੍ਰੀਤ ਸਰ ਗੱਲ ਕਰ ਰਹੇ ਹੋ ਜੀ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਸਤਵਿੰਦਰ ਸਿੰਘ ਬੋਲ ਰਿਹਾ ਜੀ ਪਟਿਆਲੇ ਤੋਂ ਸਰ ਰਜਿੰਦਰਾ ਹੋਸਪੀਟਲ ਤੋਂ ਗੱਲ ਕਰ ਰਹੇ ਨਾ ਜੀ ਤੁਸੀਂ ਤੁਹਾਡੇ ਤੋਂ ਸਰ ਮੈਨੂੰ ਤੁਹਾਡੇ ਤੋਂ ਨਾ ਇਨਫੋਰਮ ਇਨਫੋਰਮੇਸ਼ਨ ਚਾਹੀਦੀ ਸੀ ਹੋਸ ਹੋਸਪੀਟਲ ਰਿਗਾਰਡਿੰਗ ਮੇਰੇ ਨਾ ਕੋਈ ਨੋਨ ਹੈਗੇ ਆ ਪੇਸ਼ੈਂਟ ਨੇ ਉਹਨਾਂ ਨੂੰ ਐਡਮਿਟ ਕਰਵਾਉਣਾ ਸੀਗਾ ਲੰਬੇ ਸਮੇਂ ਤੋਂ ਇੱਕ ਪ੍ਰੋਬਲਮ ਨਾਲ ਜੂਝ ਰਹੇ ਆ ਬਟ ਮੈਨੂੰ ਥੋੜ੍ਹਾ ਜਿਹਾ ਪਤਾ ਨੀ ਹੈਗਾ ਹੋਸਪੀਟਲ ਬਾਰੇ ਹੈ ਨਾ ਥੋੜ੍ਹਾ ਜਿਹਾ ਜੇ ਤੁਸੀਂ ਗਾਈਡ ਕਰਦੋ ਅਤੇ ਸਰ ਮਤਲਬ ਬੈੱਡ ਸਾਨੂੰ ਪਹਿਲਾਂ ਬੁੱਕ ਕਰਾਉਣ ਦੀ ਜ਼ਰੂਰਤ ਹੈਗੀ ਆ ਮਤਲਬ ਕਿ ਉੱਥੇ ਆ ਕੇ ਮਿਲ ਜੂੰਗਾ ਸਾਨੂੰ ਅਤੇ ਸਰ ਇੱਕ ਇੱਕ ਗਾਈਡ ਹੋਰ ਕਰੋ ਕਿ ਜਿਹਨਾਂ ਤੋਂ ਤੋਂ ਪਹਿਲਾਂ ਵੀ ਨਾ ਉਹਨਾਂ ਦਾ ਇਲਾ ਇਲਾਜ ਚੱਲ ਰਿਹਾ ਸੀਗਾ ਕਾਫ਼ੀ ਲੰਬੇ ਸਮੇਂ ਤੋਂ ਅਤੇ ਰਿਪੋਰਟਸ ਨਾ ਬਹੁਤ ਮਹਿੰਗੀਆਂ ਮਹਿੰਗੀਆਂ ਕਰਵਾਈਆਂ ਹੋਈਆਂ ਨੇ ਅਤੇ ਮੈਂ ਨੀ ਚਾਹੁੰਦਾ ਵੀ ਦੁਬਾਰਾ ਦੁਬਾਰਾ ਰਿਪੋਰਟਸ ਕਰਾ ਕੇ ਹੈ ਨਾ ਸਾਡਾ ਖਰਚਾ ਵੀ ਤੁਹਾਨੂੰ ਪਤਾ ਹੀ ਹੈ ਫਿਰ ਕਾਫ਼ੀ ਆ ਜਾਂਦਾ ਵੀ ਉਹ ਪੁਰਾਣੀਆਂ ਰਿਪੋਰਟਸ ਹੀ ਚੱਲ ਜਾਣਗੀਆਂ ਜਾਂ ਦੁਬਾਰਾ ਤੋਂ ਨਵੇਂ ਸਿਰੇ ਤੋਂ ਸਾਨੂੰ ਰਿਪੋਰਟਸ ਕਰਵਾਉਣੀਆਂ ਪੈਂਦੀਆਂ ਨੇ ਐਂਵੇ ਦਾ ਕੁਛ ਹੈ ਠੀਕ ਹੈ ਜੀ ਅਤੇ ਸਰ ਹਾਂ ਅਤੇ ਸਰ ਇੱਕ ਗੱਲ ਹੋਰ ਇੱਕ ਆਯੁਸ਼ਮਾਨ ਜਿਹੜਾ ਕਾਰਡ ਆ ਉਹ ਚੱਲ ਜਾਂਦਾ ਜੀ ਹੋਸਪੀਟਲ 'ਚ ਹੈ ਫੈਸਿਲਿਟੀ ਇਹਦੀ ਬਸ ਠੀਕ ਹੈ ਠੀਕ ਹੈ ਸਰ ਸ਼ੁਕਰੀਆ ਸਰ ਥੈਂਕ ਯੂ ਵੈਰੀ ਮੱਚ